ਸਾਨੂੰ ਆਪਣੀ ਸਿਹਤ ਦੇ ਵਾਸਤੇ ਸੈਰ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਵੇਂ ਕਿ ਆਪਾਂ ਜਿੰਨੀ ਜ਼ਿਆਦਾ ਸੈਰ ਕਰਾਂਗੇ ਆਪਣਾ ਓਨਾ ਹੀ ਤੰਦਰੁਸਤ ਹੀ ਸਰੀਰ ਰਹੂਗਾ ਇਸ ਕਰਕੇ ਜਿਹੜਾ ਸਰਕਾਰ ਵੱਲੋਂ ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਪਾਰਕ ਦਾ ਉਪਲਬਧ ਕੀਤਾ ਹੈ ਵੀ ਪਾਰਕ ਦੇ ਵਿੱਚ ਜਾ ਕੇ ਆਪਣੀ ਸੈਰ ਕਰ ਸਕਦੇ ਹਨ ਵੀ ਸੈਰ ਕਰਨ ਦੇ ਨਾਲ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗੇਗਾ ਉਸ ਕਰਕੇ ਵੀ ਪਾਰਕ ਦੇ ਵਿੱਚ ਫੁੱਲ ਬੂਟੇ ਵੀ ਲਗਾਏ ਹਨ ਗਰੀਨ ਪੂਰਾ ਕੀਤਾ ਗਿਆ ਜਿਵੇਂ ਕਿ ਉਹਨਾਂ ਨੂੰ ਇਹ ਚੀਜ਼ ਲੱਗਦੀ ਹੈ ਕਿ ਵੀ ਜਿਵੇਂ ਹਰੇ ਹਰੇਵਾਈ ਹੋ ਜਾਂਦੀ ਸਾਰੇ ਵੀ ਜਿਵੇਂ ਅੱਖਾਂ ਦੀ ਰੋਸ਼ਨੀ ਵਾਸਤੇ ਬਹੁਤ ਜ਼ਿਆਦਾ ਵਧੀਆ ਵੀ ਹੁੰਦਿਆਂ ਉੱਠ ਕੇ ਪਾਰਕ ਦੇ ਵਿੱਚ ਜਾਣ ਤਾਂ ਵੀ ਪਾਰਕ ਦੇ ਵਿੱਚ ਜਾਣ ਵੀ ਉੱਥੇ ਜਿਹੜੇ ਹਰੇ ਹਰੇ ਪੌਦੇ ਆ ਵਧੀਆ ਉਹਨਾਂ ਨੂੰ ਦੇਖਣ ਉਸਦੇ ਨਾਲ ਆਪਣੀ ਜਿਹੜੀ ਅੱਖਾਂ ਦੀ ਰੋਸ਼ਨੀ ਹੈ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈ ਇਸ ਕਰਕੇ ਸਰਕਾਰ ਵੱਲੋਂ ਜਿਹੜੇ ਵੀ ਪਾਰਕ ਖੋਲ੍ਹੇ ਗਏ ਹਨ ਜਾਂ ਫੁੱਟਪਾਟ ਬਣਾਏ ਗਏ ਹਨ ਵੀ ਸਵੇਰ ਹੁੰਦਿਆਂ ਸੈਰ ਕਰਨ ਵਾਸਤੇ ਜਿਸ ਕਰਕੇ ਸੈਰ ਦੇ ਨਾਲ ਵੀ ਸਾਡੀ ਸਿਹਤ ਆ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਰਹਿੰਦੀ ਹੈਗੀ ਜਿਸ ਕਰਕੇ ਵੀ ਸਾਰਾ ਦਿਨ ਹੀ ਬਹੁਤ ਹੀ ਜ਼ਿਆਦਾ ਵਧੀਆ ਲੰਘਦਾ ਹੈਗਾ ਇਸ ਕਰਕੇ ਸੈਰ ਕਰਨ ਦੇ ਨਾਲ ਸਾਡਾ ਜਿਹੜਾ ਸਰੀਰ ਹੈ ਵਧੀਆ ਰਹਿੰਦਾ ਹੈਗਾ ਇਸ ਨਾਲ ਕੋਈ ਵੀ ਰੋਗ ਨਹੀਂ ਲੱਗਦਾ ਹੈਗਾ ਰੋਗਾਂ ਤੋਂ ਬਚ ਜਾਂਦਾ ਹੈ ਸੈਰ ਕਰਨ ਦੇ ਨਾਲ ਸਾਡੇ ਕਈ ਰੋਗ ਟੁੱਟ ਜਾਂਦੇ ਹਨ ਇਸ ਲਈ ਸਰਕਾਰ ਵੱਲੋਂ ਜਿਹੜੇ ਪਾਰਕ ਜਾਂ ਫੁੱਟਪਾਥ ਵੀ ਸਾਰੇ ਜਿਹੜੇ ਰੋਜ਼ ਗਾਰਡਨ ਵਗੈਰਾ ਕਿੰਨੇ ਹੀ ਸ਼ਹਿਰਾਂ ਹਰੇਕ ਪਿੰਡ ਹਰੇਕ ਸ਼ਹਿਰ ਦੇ ਵਿੱਚ ਪਾਰਕ ਜਾਂ ਫੁੱਟਪਾਥ ਉਪਲਬਧ ਹਨ ਇਸ ਕਰਕੇ ਸਾਨੂੰ ਸੈਰ ਕਰਨ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ ਇਸ ਕਰਕੇ ਸਾਨੂੰ ਸੈਰ ਕਰਨ ਦਾ ਬਹੁਤ ਹੀ ਯੋਗ ਹੋਵੇਗਾ ਥੈਂਕ ਯੂ